ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸ਼ਗੁਨ ਢਾਬੇ ਤੋਂ ਬੋਲ ਰਹੇ ਹੋ ਜੀ ਹਾਂਜੀ ਸਰ ਮੈਂ ਮਹਿੰਦਰਪਾਲ ਬੋਲ ਰਿਹਾ ਐਡਵੋਕੇਟ ਹਾਂਜੀ ਹੋਰ ਸਰ ਠੀਕ ਹੋ ਜੀ ਸਰ ਮੈਂ ਨਾ ਜਿਹੜਾ ਤੁਹਾਡੇ ਕੋਲੋਂ ਓਡਰ ਮੰਗਵਾਉਂਦਾ ਸੀਗਾ ਸ਼ਾਹੀ ਪਨੀਰ ਸੀਗਾ ਅਤੇ ਨਾਲ਼ ਉਹ ਤੰਦੂਰੀ ਰੋਟੀਆਂ ਸੀਗੀਆਂ ਅਤੇ ਇੱਕ ਮਿਕਸ ਵੈਜ ਹੈ ਸਰ ਉਹ ਮੇਰਾ ਓਡਰ ਅੱਗੇ ਵੀ ਮੈਂ ਤੁਹਾਤੋਂ ਮੰਗਵਾਉਂਦਾ ਹੈ ਅਤੇ ਉਹ ਮੇਰਾ ਪਲੀਸ ਰਪੀਟ ਕਰ ਦਿਉ ਅਤੇ ਜਿਹੜਾ ਵੀ ਡਿਲੀਵਰੀ ਬੁਆਏ ਆਏਗਾ ਉਹਨੂੰ ਦੱਸ ਦਿਉ ਮੇਰੇ ਘਰ ਦਾ ਮੈਂ ਉੱਥੇ ਮਿਲੂੰਗਾ ਜੀ ਅਤੇ ਸਰ ਕੰਫਰਮ ਆ ਮੇਰਾ ਓਡਰ ਕਰਦੂੰਗੇ ਤੁਸੀਂ ਟਾਈਮ ਸਿਰ ਇਹਨੂੰ ਪਲੀਜ ਪਹੁੰਚਾ ਦਿਉ ਧੰਨਵਾਦ ਜੀ